ਸਿੱਖਿਆ ਰੁਜ਼ਗਾਰ ਦੇ ਰੂਪ ਵਿੱਚ ਪਟਿਆਲੇ ਜ਼ਿਲ੍ਹੇ ਦੇ ਨੌਜਵਾਨਾਂ ਦੇ ਸਾਹਮਣੇ ਬਹੁਤ ਸਾਰੀ ਮੁਸ਼ਕਿਲਾਂ ਆ ਰਹੀਆਂ ਹਨ ਪਹਿਲਾਂ ਤਾਂ ਇੱਥੇ ਪਟਿਆਲਾ ਸ਼ਹਿਰ ਤੋਂ ਇਲਾਵਾ ਕਿਤੇ ਕੋਈ ਹੋਰ ਚੰਗਾ ਸਕੂਲ ਜਾਂ ਕਾਲਜ ਨਹੀਂ ਹੈ ਲੀਡਰਸ਼ਿਪ ਦੇ ਰੂਪ ਵਿੱਚ ਵੀ ਲੋਕਾਂ ਨੂੰ ਕੁਝ ਖਾਸ ਦੇਖਣ ਨੂੰ ਨਹੀਂ ਮਿਲਦਾ ਜਿਹੜੇ ਲੋਕ ਕਾ ਕੋਲ ਪਹਿਲਾਂ ਹੀ ਲੀਡਰਸ਼ਿਪ ਹੁੰਦੀ ਸੀ ਉਹ ਆਪਣੇ ਜਾਣ ਪਛਾਣ ਦੇ ਲੋਕਾਂ ਨੂੰ ਵੀ ਲੀਡਰਸ਼ਿਪ ਦੇ ਦਿੰਦੇ ਹਨ ਅਤੇ ਕਿਸੇ ਦੂਸਰੇ ਵਿਅਕਤੀ ਨੂੰ ਮੌਕਾ ਨਹੀਂ ਦਿੰਦੇ ਜਿਸ ਕਾਰਨ ਬਹੁਤ ਸਾਰੇ ਨੋਜਵਾਨ ਬਾਹਰ ਵੱਲ ਰੁਝਾਨ ਕਰਦੇ ਜਾ ਰਹੇ ਹਨ ਨੌਜਵਾਨਾਂ ਨੂੰ ਪੜ੍ਹ ਲਿਖ ਕੇ ਵੀ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਨੌਜਵਾਨ ਇਨਾਂ ਪੜ੍ਹ ਲਿਖ ਕੇ ਡਿਗਰੀਆਂ ਪ੍ਰਾਪਤ ਕਰਕੇ ਵੀ ਬੇਰੁਜ਼ਗਾਰ ਹਨ ਜਿਸ ਕਰਕੇ ਉਹ ਬਹੁਤ ਨਿਰਾਸ਼ ਰਹਿੰਦੇ ਹਨ ਉਹ ਇੰਨੀਆਂ ਉੱਚੀਆਂ ਡਿਗਰੀਆਂ ਪ੍ਰਾਪਤ ਕਰਕੇ ਵੀ ਪੰਜ ਜਾਂ ਸੱਤ ਹਜ਼ਾਰ ਵਿੱਚ ਦੁਕਾਨਾਂ ਉੱਪਰ ਕੰਮ ਕਰਨ ਲੱਗੇ ਹੁੰਦੇ ਹਨ